ਹੈਲੋ ਠੀਕ ਆ ਭਾਅ ਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਭਾਅ ਜੀ ਆਪਣੇ ਇੱਥੇ ਅੰਮ੍ਰਿਤਸਰ ਜਿਲ੍ਹੇ 'ਚ ਪੈਂਦਾ ਵਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਉੱਥੇ ਮਤਲਬ ਕਿ ਸਾਰੀਆਂ ਫਲਾਈਟਸ ਜਾਂਦੀਆਂ ਵਾ ਆਪਾਂ ਛੋਟੇ ਸ਼ਹਿਰਾਂ ਜਿਵੇਂ ਰਾਜਸਥਾਨ ਹਰਿਆਣਾ ਚੰਡੀਗੜ੍ਹ ਜਿਵੇਂ ਇੱਥੇ ਵੀ ਜਾਣਾ ਜਾਂ ਆਪਾਂ ਦੂਰ ਕਿਤੇ ਜਾਣਾ ਵਾ ਤਾਂ ਇੱਥੇ ਆ ਕੇ ਸਮੇਂ ਦਾ ਤੁਸੀਂ ਪਤਾ ਕਰੋ ਅਤੇ ਤੁਸੀਂ ਜਿਹੜੀ ਮਰਜ਼ੀ ਫਲਾਈਟ ਜਦੋਂ ਮਰਜ਼ੀ ਲੈ ਸਕਦੇ ਜੇ ਇੱਕ ਤਾਂ ਤੁਹਾਨੂੰ ਇਹ ਬਿਲਕੁਲ ਮਤਲਬ ਕਿ ਲਾਗੇ ਆ ਸਮਾਂ ਵੀ ਤੁਹਾਡਾ ਬਚ ਜਾਣਾ ਕਿੰਨਾ ਆਉਣ ਜਾਣ 'ਚ ਅਤੇ ਦੂਜੀ ਗੱਲ ਜੇ ਤੁਸੀਂ ਮਤਲਬ ਕਿ ਚੰਡੀਗੜ੍ਹ ਵੀ ਆਪਣੀ ਹੈਗਾ ਵਾ ਉੱਥੇ ਹੈਗਾ ਵਾ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਉੱਥੇ ਵੀ ਜਾ ਕੇ ਤੁਸੀਂ ਪੁੱਛ ਸਕਦੇ ਜੇ ਆਪਣਾ ਕਿੱਥੇ ਵੀ ਤੁਸੀਂ ਜਾਣਾ ਹਾਂਜੀ ਉਹ ਦੂਰ ਪਊਗਾ ਇੱਥੇ ਅੰਮ੍ਰਿਤਸਰ ਵਾਲਾ ਇਹ ਤੁਹਾਨੂੰ ਲਾਗੇ ਪੈਣਾ ਅਤੇ ਵੈਸੇ ਤਾਂ ਬਠਿੰਡੇ ਵੀ ਹੈਗਾ ਵਾ ਉਹ ਵੀ ਹਵਾਈ ਅੱਡਾ ਉੱਥੇ ਵੀ ਹੈਗਾ ਤੁਸੀਂ ਉੱਥੋਂ ਵੀ ਪੁੱਛ ਸਕਦੇ ਜੇ ਹਾਂਜੀ ਤੁਹਾਨੂੰ ਇਹ ਹੀ ਅੰਮ੍ਰਿਤਸਰ ਵਾਲਾ ਜਿਹੜਾ ਵਾ ਇਹ ਲਾਗੇ ਪੈਣਾ ਜੇ ਹਾਂਜੀ ਚੰਡੀਗੜ੍ਹ ਵਾਲਾ ਵੀ ਵੈਸੇ ਤੁਸੀਂ ਦੇਖ ਲਿਓ ਦੋਵੇਂ ਥਾਵਾਂ ਦਾ ਪਤਾ ਕਰ ਕੇ ਦੇਖ ਲਿਓ ਜਿੱਥੇ ਤੁਹਾਨੂੰ ਵਧੀਆ ਲੱਗੂ ਗਾ ਬਠਿੰਡੇ ਦਾ ਤੁਹਾਨੂੰ ਦੂਰ ਪੈ ਜਾਣਾ ਠੀਕ ਹੈ ਭਾਅ ਜੀ ਹਾਂਜੀ